ਗੋਡਿਆਂ ਦਾ ਦਰਦ ਅੱਜ ਕੱਲ੍ਹ ਆਮ ਸਮੱਸਿਆ ਬਣ ਗਈ ਹੈ ਗੋਡਿਆਂ ਦਾ ਦਰਦ ਬਜ਼ੁਰਗ ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ ਅਤੇ ਗੋਡਿਆਂ ਦੇ ਦਰਦ ਲਈ ਸਾਡੇ ਪਿੰਡ ਵਿੱਚ ਵੀ ਕੁਝ ਘਰੇਲੂ ਉਪਚਾਰ ਕੀਤੇ ਜਾਂਦੇ ਹਨ ਇਹਨਾਂ ਘਰੇਲੂ ਉਪਚਾਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗਰਮ ਤੇਲ ਦੀ ਮਾਲਿਸ਼ ਹੈ ਜੋ ਕਿ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਕੀਤੀ ਜਾਂਦੀ ਹੈ ਇਹ ਮਾਲਿਸ਼ ਪੰਦਰਾਂ ਤੋਂ ਵੀਹ ਮਿੰਟ ਦੇ ਵਿੱਚ ਕੀਤੀ ਜਾਂਦੀ ਹੈ ਤੇਲ ਨੂੰ ਹਲਕਾ ਗਰਮ ਕੀਤਾ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਉਸਦੀ ਮਸਾਜ ਕੀਤੀ ਜਾਂਦੀ ਹੈ ਤਾਂ ਜੋ ਉਹ ਤੇਲ ਅੰਦਰ ਚੰਗੀ ਤਰ੍ਹਾਂ ਗੋਡਿਆਂ ਦੇ ਵਿੱਚ ਰਚ ਜਾਵੇ ਇਸ ਤੋਂ ਇਲਾਵਾ ਵੀ ਕੁਝ ਘਰੇਲੂ ਉਪਚਾਰ ਹਨ ਇਹਨਾਂ ਉਪਚਾਰਾਂ ਦੇ ਵਿੱਚੋਂ ਇੱਕ ਹੈ ਰੇਤ ਦੀ ਪੋਟਲੀ ਭਾਵ ਰੇਤ ਨੂੰ ਗਰਮ ਕੀਤਾ ਜਾਂਦਾ ਹੈ ਰੇਤ ਜਾਂ ਬਰੇਤੀ ਕਹਿ ਸਕਦੇ ਹਾਂ ਆਪਾਂ ਉਸਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਸਨੂੰ ਇੱਕ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਲਪੇਟ ਲਿੱਤਾ ਜਾਂਦਾ ਹੈ ਫਿਰ ਉਸਦਾ ਸੇਕ ਗੋਡਿਆਂ ਨੂੰ ਦਿੱਤਾ ਜਾਂਦਾ ਹੈ ਇਸ ਸੇਕ ਨਾਲ ਵੀ ਗੋਡਿਆਂ ਨੂੰ ਕਾਫ਼ੀ ਆਰਾਮ ਮਿਲਦਾ ਹੈ ਗੋਡਿਆਂ ਦਾ ਦਰਦ ਇਸ ਸੇਕ ਨਾਲ ਕਾਫ਼ੀ ਘੱਟ ਹੁੰਦਾ ਹੈ ਇਸ ਤੋਂ ਇਲਾਵਾ ਗਰਮ ਰੋਟੀ ਗਰਮ ਰੋਟੀ ਜੇ ਗੋਡੇ ਉੱਤੇ ਬੰਨਦੇ ਹਾਂ ਭਾਵ ਉਸ ਦੀ ਥੋੜ੍ਹੀ ਜਿਹੀ ਭਾਫ਼ ਕੱਢ ਕੇ ਰੋਟੀ ਗਰਮ ਗੋਡੇ 'ਤੇ ਬੰਨਦੇ ਹਾਂ ਤਾਂ ਉਸ ਨਾਲ ਵੀ ਗੋਡਿਆਂ ਦੇ ਦਰਦ ਨੂੰ ਕਾਫ਼ੀ ਜ਼ਿਆਦਾ ਰਾਹਤ ਮਿਲਦੀ ਹੈ ਇਹ ਕੁਝ ਪ੍ਰਸਿੱਧ ਘਰੇਲੂ ਉਪਚਾਰ ਹਨ ਜੋ ਸਾਡੇ ਪਿੰਡ ਵਿੱਚ ਵਰਤੇ ਜਾਂਦੇ ਹਨ ਇਹ ਉਪਚਾਰ ਬਹੁਤ ਫਾਇਦੇਮੰਦ ਹਨ ਇਹ ਉਪਚਾਰ ਐਵੇਂ ਹੀ ਨਹੀਂ ਬਣੇ ਇਹਨਾਂ ਉਪਚਾਰਾਂ ਦਾ ਕੋਈ ਫਾਇਦਾ ਸੀ ਜਾਂ ਫਿਰ ਅੱਜ ਵੀ ਲੋਕਾਂ ਨੂੰ ਇਹਨਾਂ ਉਪਚਾਰਾਂ ਦਾ ਫਾਇਦਾ ਹੋ ਰਿਹਾ ਹੈ ਤਾਂ ਕਰਕੇ ਲੋਕ ਇਹ ਘਰੇਲੂ ਉਪਚਾਰ ਵਰਤਦੇ ਹਨ